ਹੈਲੋ ਹਾਂਜੀ ਸਤਿ ਸ੍ਰੀ ਅਕਾਲ ਦੀਦੀ ਮੈਂ ਪ੍ਰੀਤੀ ਦੀ ਸਿਸਟਰ ਬੋਲਦੀ ਹਾਂ ਤੁਹਾਡੇ ਨਾਲ ਪੜ੍ਹਦਾ ਹਾਂਜੀ ਹਾਂਜੀ ਤੁਹਾਡੇ ਨਾਲ ਪੜ੍ਹਦੇ ਹੁੰਦੇ ਸੀ

ਵਧੀਆ ਦੀਦੀ ਤੁਸੀਂ ਦੱਸੋ ਹੋਰ ਹੋਰ ਕੀ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਐਕਚੁਲੀ ਮੈਂ ਤੁਹਾਡੇ ਕਾਲਜ 'ਚ ਐਡਮਿਸ਼ਨ ਲਈ ਹੈ ਬਾਬਾ ਬਲਰਾਜ ਕਾਲਜ ਹਾਂਜੀ ਹਾਂਜੀ ਅਤੇ ਮੈਂ ਪੁੱਛਣਾ ਸੀ ਵੀ ਮੈਂ ਇੱਥੇ ਮਤਲਬ ਵੈਦਰ ਕਿੱਦਾਂ ਦਾ ਹੈ ਮੈਂ ਕਿਵੇਂ ਦੇ ਕੱਪੜੇ ਲੈ ਕੇ ਆਵਾਂ ਮਤਲਬ ਨਾਲ ਆਪਣੇ ਜਿਵੇਂ ਜੀ ਹਾਂਜੀ ਹਾਂਜੀ ਹੋ ਹਾਂਜੀ

ਅੱਛਾ ਅਹਾਂ ਬਸ ਮੈਂ ਤਿੰਨ ਚਾਰ ਦਿਨਾਂ ਤੱਕ ਹੀ ਆ ਜਾਣਾ ਹਾਂਜੀ ਹਾਂਜੀ ਕੋਈ ਗੱਲ ਨੀ ਬਸ ਐਕਚੁਲੀ ਲੈ ਲਈ ਨਾ ਹੁਣ ਫੀਸ ਵਗੈਰਾ ਵੀ ਅਤੇ ਕਰਤੀ ਮੀਨਜ਼ ਉੱਥੇ ਸਾਰਾ ਕੁਛ ਲੈ ਐਡਮਿਸ਼ਨ ਹਾਂਜੀ ਹਾਂਜੀ ਬਸ ਦੋ ਚਾਰ ਮਹੀਨੇ ਬਾਅਦ ਹੀ ਜਾਣ

ਹਾਂਜੀ ਓਕੇ ਦੀਦੀ ਠੀਕ ਹੈ ਹਾਂਜੀ ਹਾਂਜੀ ਕੋਈ ਗੱਲ ਨੀ ਥੈਂਕ ਯੂ ਓਕੇ ਓਕੇ ਓਕੇ ਓਕੇ